ਸਿੱਖਿਆ ਨੂੰ ਆਮ ਤੌਰ 'ਤੇ ਪ੍ਰੀ ਪ੍ਰਾਇਮਰੀ ਸਕੂਲ ਪ੍ਰਾਇਮਰੀ ਸਕੂਲ ਸੈਕੰਡਰੀ ਸਕੂਲ ਅਤੇ ਫਿਰ ਕਾਲਜ ਯੂਨੀਵਰਸਿਟੀ ਦੇ ਪੜਾਵਾਂ ਵਿੱਚ ਵੰਡਿਆ ਗਿਆ ਕੁਝ ਸਰਕਾਰਾਂ ਅਤੇ ਸੰਯੁਕਤ ਰਾਸ਼ਟਰ ਦੁਆਰਾ ਸਿੱਖਿਆ ਦੇ ਅਧਿਕਾਰ ਨੂੰ ਮਾਨਤਾ ਦਿੱਤੀ ਗਈ ਹੈਗੀ ਦੁਨੀਆਂ ਦੇ ਜ਼ਿਆਦਾਤਰ ਖੇਤਰ ਵਿੱਚ ਕਿਸੇ ਖਾਸ ਉਮਰ ਦੇ ਲਈ ਸਿੱਖਿਆ ਨੂੰ ਲਾਜ਼ਮੀ ਬਣਾਇਆ ਗਿਆ ਹਰੇਕ ਸਮਾਜ ਦਾ ਆਪਣਾ ਆਪਣਾ ਜੀਵਨ ਢੰਗ ਹੈਗਾ ਸਮਾਜ ਦਾ ਜਿਉਣ ਢੰਗ ਕੁਝ ਆਦਤਾਂ ਸੰਕੇਤਾਂ ਰਸਮਾਂ ਅਤੇ ਭੌਤਿਕ ਅਤੇ ਸਥਾਨਕ ਕੰਮਾਂ ਕਾਰਾਂ ਵਿੱਚ ਬੱਝਿਆ ਹੈਗਾ ਇਹ ਸਾਰਾ ਕੁਝ ਸਮਾਜਿਕ ਗਿਆਨ ਦੇ ਸਹਾਰੇ ਚੱਲਦਾ ਰਿਹਾ ਅਤੇ ਚੱਲਦਾ ਰਹੇਗਾ ਹਰੇਕ ਸਮਾਜ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣਾ ਹਾਸਲ ਅਤੇ ਗਿਆਨ ਵੰਡਦਾ ਹੈ ਵਰਤਮਾਨ ਸਮੇਂ ਵਿੱਚ ਹਰ ਸਮਾਜ ਦਾ ਆਪਣਾ ਵੱਖਰਾ ਸਿੱਖਿਆ ਢਾਂਚਾ ਵਿਕਸਿਤ ਕਰ ਲਿਆ ਅੱਜ ਕੱਲ੍ਹ ਦੇ ਦੌਰ ਵਿੱਚ ਸਿੱਖਿਆ ਦਾ ਜ਼ਿਆਦਾਤਰ ਕੰਮ ਪੜ੍ਹਨ ਲਿਖਣ ਦੀ ਵਿਧੀ ਰਾਹੀਂ ਲੋਕਾਂ ਤੱਕ ਪਹੁੰਚ ਰਿਹਾ ਪੜ੍ਹਨ ਲਿਖਣ ਦੀ ਵਿਧੀ ਦੀ ਵਰਤੋਂ ਹੋਰ ਦੂਜੀਆਂ ਵਿਧੀਆਂ ਤੋਂ ਜ਼ਿਆਦਾ ਪ੍ਰਯੋਗ ਹੁੰਦੀ ਹੈ ਸਿੱਖਿਆ ਪ੍ਰਣਾਲੀ ਦਾ ਢਾਂਚਾ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ ਤਾਂ ਜੋ ਹਰੇਕ ਵਰਗ ਦੇ ਵਿਅਕਤੀ ਨੂੰ ਸਿੱਖਿਆ ਮਿਲ ਸਕੇ ਸਿੱਖਿਆ ਹਰੇਕ ਵਿਅਕਤੀ ਨੂੰ ਹੋਣੀ ਬਹੁਤ ਜ਼ਰੂਰੀ ਹੈ ਤਾਂ ਜੋ ਆਉਣ ਵਾਲਾ ਸਮਾਜ ਤਰੱਕੀ ਕਰ ਸਕੇ ਅਤੇ ਹਰੇਕ ਨੂੰ ਆਪਣਾ ਜੀਵਨ ਬਿਤਾਉਣ ਦੀ ਜਾਂਚ ਆ ਸਕੇ ਸਿੱਖਿਆ ਸਿਰਫ ਇੱਕ ਪੜ੍ਹਾਈ ਤੱਕ ਹੀ ਸੀਮਤ ਨਹੀਂ ਹੁੰਦੀ ਜਦੋਂ ਕਿ ਆਮ ਜ਼ਿੰਦਗੀ ਵਿੱਚ ਜਿਉਣ ਲਈ ਅਤੇ ਆਮ ਨਿਰਦੇਸ਼ਾਂ ਅਨੁਸਾਰ ਜਿਉਣ ਲਈ ਅਤੇ ਆਮ ਸਮਾਜਿਕ ਭਾਈਚਾਰੇ ਵਿੱਚ ਵਰਤਣ ਲਈ ਸਿੱਖਿਆ ਦਾ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਇੱਕ ਵਿਅਕਤੀ ਆਪਣੀ ਜ਼ਿੰਦਗੀ ਦੇ ਜਿਉਣ ਦੇ ਢੰਗ ਸੌਖੇ ਕਰ ਸਕੇ ਅਤੇ ਹਰੇਕ ਕਿਸੇ ਨਾਲ ਵਰਤ ਸਕੇ ਸਿੱਖਿਆ ਪ੍ਰਣਾਲੀ ਦਿਨੋਂ ਦਿਨ ਨਵੀਆਂ ਜਦੋਂ ਪੰਜਾਬ ਸਰਕਾਰ ਸਹੂਲਤਾਂ ਕੱਢਦੀ ਹੈ ਤਾਂ ਸਿੱਖਿਆ ਪ੍ਰਣਾਲੀ ਹੋਰ ਵੀ ਵਿਕਸਿਤ ਹੁੰਦੀ ਹੈ ਸਿੱਖਿਆ ਦੇ ਪ੍ਰਤੀ ਪੰਜਾਬ ਸਰਕਾਰ ਨਵੀਆਂ ਤੋਂ ਨਵੀਆਂ ਸਹੂਲਤਾਂ ਕੱਢ ਕੇ ਹਰੇਕ ਵਰਗ ਦੇ ਲਈ ਸਹੂਲਤਾਂ ਤਾਂ ਜੋ ਹਰੇਕ ਵਰਗ ਦਾ ਉਮਰ ਵੀ ਉਮਰ ਦਾ ਵਿਅਕਤੀ ਵੀ ਪੜ੍ਹ ਸਕਦਾ ਹੈ ਹੁਣ ਸਿੱਖਿਆ ਲੈਣੀ ਹਰੇਕ ਵਿਅਕਤੀ ਲਈ ਸੌਖੀ ਅਤੇ ਆਸਾਨ ਹੈ ਹੁਣ ਗਰੀਬ ਪਰਿਵਾਰ ਦਾ ਆਦਮੀ ਵੀ ਸਿੱਖਿਆ ਲੈ ਸਕਦਾ ਹੈ ਜਿੱਥੇ ਇੱਕ ਆਦਮੀ ਲੈਣ ਲਈ ਆਦਮੀ ਨੂੰ ਸਿੱਖਿਆ ਲੈਣੀ ਆਸਾਨ ਹੈ ਉੱਥੇ ਆਦਮੀ ਦੇ ਨਾਲ ਨਾਲ ਔਰਤ ਨੂੰ ਵੀ ਸਿੱਖਿਆ ਤੋਂ ਵਾਂਝਾ ਨਹੀਂ ਰੱਖਿਆ ਗਿਆ ਹੈ ਔਰਤ ਨੂੰ ਵੀ ਉਨਾ ਹੀ ਅਧਿਕਾਰ ਹੈ ਜਿੰਨਾ ਕਿ ਇੱਕ ਆਦਮੀ ਨੂੰ ਸਿੱਖਿਆ ਦਾ ਅਧਿਕਾਰ ਹੈ ਇਸ ਨਾਲ ਦੋਨਾਂ ਨੂੰ ਬਰਾਬਰ ਸਮਝਿਆ ਜਾਂਦਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਕੁੜੀ ਅਤੇ ਮੁੰਡੇ ਵਿੱਚ ਕੋਈ ਫਰਕ ਨਹੀਂ ਰੱਖਿਆ ਗਿਆ ਦੋਨਾਂ ਨੂੰ ਬਰਾਬਰ ਸਮਝਿਆ ਗਿਆ ਹੈ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ ਹੈ ਸਿੱਖਿਆ ਦੇ ਢੰਗ ਤੋਂ ਕਿਸੇ ਵੀ ਪ੍ਰਕਾਰ ਤੋਂ ਕਿਸੇ ਤਰ੍ਹਾਂ ਵੀ ਵਾਂਝਾ ਨਹੀਂ ਰੱਖਿਆ ਗਿਆ